ਤਾਕਤ ਅਤੇ ਲਚਕਤਾ ਦੀ ਸਿਖਾਈ ਗੱਲ ਕਰੀਏ ਤਾਂ ਸਵੇਰੇ ਸਭ ਤੋਂ ਪਹਿਲਾਂ ਰਨਿੰਗ ਕਰਨ ਤੋਂ ਪਹਿਲਾਂ ਮੈਂ ਸਟਰੈਚਿੰਗ ਕਰਦਾ ਹਾਂ ਸਟਰੈਚਿੰਗ ਦੇ ਨਾਲ ਪੂਰਾ ਸਰੀਰ ਜਿਹੜਾ ਹੈਗਾ ਉਹ ਖੁੱਲ੍ਹ ਜਾਂਦਾ ਹੈ ਖ਼ੁਲ੍ਹਣ ਤੋਂ ਬਾਅਦ ਥੋੜ੍ਹੀ ਦੇਰ ਤੱਕ ਮੈਂ ਬਿਲਕੁਲ ਹਲਕੇ ਹਲਕੇ ਕਦਮਾਂ ਨਾਲ ਸਲੋ ਸਲੋ ਰਨਿੰਗ ਕਰਦਾ ਹਾ ਉਸ ਤੋਂ ਬਾਅਦ ਮੈਂ ਆਪਣੀ ਸਟਰੈਂਥ ਦੇ ਮੁਤਾਬਿਕ ਰਨਿੰਗ ਦੀ ਗਤੀ ਨੂੰ ਵਧਾਉਂਦਾ ਜਾਂਦਾ ਹਾਂ ਅਤੇ ਤਕਰੀਬਨ ਪੰਜ ਛੇ ਕਿਲੋਮੀਟਰ ਦੌੜ ਰਿਹਾ ਦੌੜ ਖਤਮ ਕਰਨ ਤੋਂ ਪਹਿਲਾਂ ਮੈਂ ਸੌ ਸੌ ਮੀਟਰ ਦੀਆਂ ਦੋ ਸਪ੍ਰਿੰਟਾਂ ਲਾਉਂਦਾ ਹਾਂ ਜੋ ਕਿ ਮੇਰੇ ਫੇਫੜਿਆਂ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੰਦੀਆਂ ਹਨ ਉਸ ਤੋਂ ਬਾਅਦ ਫਿਰ ਮੈਂ ਤਕਰੀਬਨ ਵੀਹ ਤੋਂ ਪੱਚੀ ਮਿੰਟ ਐਕਸਰਸਾਈਜ਼ ਕਰਦਾ ਹਾਂ ਉਹ ਐਕਸਰਸਾਈਜ਼ਾਂ ਜੋ ਕਿ ਜਿਹਨਾਂ ਦੇ ਵਿੱਚ ਜੰਪ ਸ਼ਾਮਿਲ ਹੋ ਜਾਪਿੰਗ ਐਕਸਰਸਾਈਜ ਕਰਨ ਤੋਂ ਬਾਅਦ ਫਿਰ ਡੰਡ ਬੈਠਕਾਂ ਜਿਹਨਾਂ ਦੇ ਨਾਲ ਬਾਹਾਂ ਮਜ਼ਬੂਤ ਹੁੰਦੀਆਂ ਹਨ ਉਸ ਤੋਂ ਬਾਅਦ ਵੀਹ ਪੱਚੀ ਮਿੰਟ ਇਹ ਐਕਸਰਸਾਈ ਕਰਨ ਤੋਂ ਬਾਅਦ ਫੇਰ ਮੈਂ ਸਟੈਚਿੰਗ ਐਕਸਰਸਾਈਜ਼ ਕਰਦਾ ਹਾਂ ਸਟਰੈਚਿੰਗ ਐਕਸਰਸਾਈਜ ਸਰੀਰ ਦੇ ਜਿੰਨੇ ਵੀ ਮਸਲਾਂ ਦੇ ਵਿੱਚ ਖਿਚਾਵ ਆਇਆ ਹੁੰਦਾ ਉਹਨਾਂ ਨੂੰ ਰਲੀਜ ਕਰਨ ਦਾ ਬਹੁਤ ਵਧੀਆ ਤਰੀਕਾ ਹੈ ਸਟਰੈਚਿੰਗ ਅਕਸਜਸਾਇਜ ਦੇ ਵਿਚ ਮੈ ਜ਼ਿਆਦਾਤਰ ਲੱਤਾਂ ਕਮਰ ਅਤੇ ਬਾਹਾਂ ਗਰਦਨ ਇਹਨਾਂ ਦੀ ਐਕਸਰਸਾਈਜ਼ ਕਰਦਾ ਹਾਂ ਜਿਸ ਨਾਲ ਕਾਫੀ ਹੱਦ ਤੱਕਰ ਸਰੀਰ ਦੇ ਵਿੱਚ ਲਚੀਲਾਪਣ ਆਉਂਦਾ ਹੈ ਅਤੇ ਸਰੀਰ ਬਿਲਕੁਲ ਰਿਲੈਕਸ ਹੋ ਜਾਂਦਾ ਹੈ